ਰੋਪੜ ਸ਼ਹਿਰ ਵਿੱਚ ਮਨੋਰੰਜਨ ਦੇ ਕਈ ਸਾਧਨ ਹਨ ਜਿਵੇਂ ਕਿ ਪਾਰਕਾਂ ਹਨ ਪਾਰਕਾਂ ਵਿੱਚ ਲੋਕ ਸੁਬਾਹ ਸੈਰ ਕਰਨ ਆਉਂਦੇ ਹਨ ਪਾਰਕਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਸਭ ਆਉਂਦੇ ਹਨ ਸੁਬਾਹ ਸ਼ਾਮ ਆਉਂਦੇ ਹਨ ਸੁਬਾਹ ਸੈਰ ਕਰਨ ਆਉਂਦੇ ਹਨ ਅਤੇ ਬੱਚੇ ਸ਼ਾਮ ਟਾਈਮ ਪਾਰਕਾਂ ਵਿੱਚ ਝੁੱਲੇ ਵਗੈਰਾ 'ਤੇ ਖੇਡਦੇ ਹਨ ਅਤੇ ਲੋਕ ਆਪਣੀਆਂ ਪਾਰਟੀਆਂ ਵਗੈਰਾ ਪਾਰਕਾਂ ਵਿੱਚ ਕਰਦੇ ਹਨ ਅਤੇ ਪਾਰਕਾਂ ਵਿੱਚ ਵਧੀਆ ਕਸਰਤ ਕਰਨ ਲਈ ਵੀ ਬਹੁਤ ਝੁੱਲੇ ਵਗੈਰਾ ਲਗਾਏ ਹੋਏ ਹਨ ਇਹ ਰੋਪੜ ਸ਼ਹਿਰ ਵਿੱਚ ਖੇਡਾਂ ਲਈ ਵੀ ਬਹੁਤ ਵਧੀਆ ਸਹੂਲਤਾਂ ਹਨ ਜਿਵੇਂ ਕਿ ਇੱਕ ਬਹੁਤ ਵੱਡਾ ਨਹਿਰੂ ਸਟੇਡੀਅਮ ਹੈ ਸਟੇਡੀਅਮ ਵਿੱਚ ਕਈ ਤਰਾਂ ਦੇ ਗਰਾਊਂਡ ਹਨ ਵੱਡੇ ਵੱਡੇ ਗਰਾਊਂਡ ਫੁੱਟਬਾਲ ਗਰਾਊਂਡ ਬਾਸਕਟਬਾਲ ਗਰਾਉਂਡ ਅ ਖੇਡਾਂ ਇੱਥੇ ਰਾਜ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ ਗਰਾਊਂਡਾਂ ਵਿੱਚ ਅ ਅਤੇ ਰੋਪੜ ਸ਼ਹਿਰ ਵਿੱਚ ਥੀਏਟਰ ਵਗੈਰਾ ਹਨ ਲੋਕ ਇੱਥੇ ਫਿਲਮਾਂ ਵਗੈਰਾ ਦੇਖਣ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ ਰੋਪੜ ਸ਼ਹਿਰ ਵਿੱਚ ਗੁਰਦੁਆਰੇ ਵੀ ਹਨ ਗੁਰਦੁਆਰਿਆਂ ਵਿੱਚ ਕੀਰਤਨ ਕਥਾ ਸੁਬਾਹ ਸ਼ਾਮ ਚੱਲਦਾ ਰਹਿੰਦਾ ਹੈ ਅਤੇ ਦੂਰ ਦੂਰ ਤੋਂ ਲੋਕ ਆਉਂਦੇ ਹਨ ਲੰਗਰ ਵਗੈਰਾ ਵੀ ਚਲਦੇ ਰਹਿੰਦੇ ਹਨ